ਹਾਂਜੀ ਹਾਂਜੀ ਹਾਂਜੀ ਦੁੱਧ ਲੈ ਜੋ ਜੀ ਕਿੰਨਾ ਲੈ ਕੇ ਜਾਣਾ ਦੱਸੋ ਲੈ ਜਿਓ ਦੁੱਧ ਲੈ ਜਿਓ ਜੀ ਅੱਛਾ ਮਿਲ ਜੂਗਾ ਜੀ ਮੱਝ ਦਾ ਦੁੱਧ ਵੀ ਮਿਲਜੂ ਅਤੇ ਗਾਂ ਦਾ ਦੁੱਧ ਵੀ ਮਿਲਜੂ ਹਾਂਜੀ ਹਾਂਜੀ ਸਾਫ ਅਤੇ ਵਧੀਆ ਦੁੱਧ ਮਿਲੇਗਾ ਜੀ ਗਾਂ ਦਾ ਵੀ ਮਿਲੂ ਅਤੇ ਮੱਝ ਦਾ ਵੀ ਮਿਲੂ ਬੋਲੋ ਹਾਂਜੀ ਦੁੱਧ ਸਾਫ ਦੇਵਾਂਗੇ ਮੱਝ ਦਾ ਦੁੱਧ ਦੇਵਾਂਗੇ ਪਿਓਰ ਮੱਝ ਦਾ ਦੁੱਧ ਦੇਵਾਂਗੇ ਸੱਤਰ ਰੁਪਏ ਕਿੱਲੋ ਲੱਗੇਗਾ ਨਹੀਂ ਦੱਸਣਾ ਠੀਕ ਹੁੰਦਾ ਨਾ ਭੇਜ ਦਿਓ ਜੀ ਭੇਜ ਦਿਓ ਤੁਸੀਂ ਸਾਢੇ ਛੇ ਵਜੇ ਭੇਜਿਓ ਜੀ ਹਾਂ ਕਿੰਨਾ ਹਾਂਜੀ ਕੈ ਕਿੱਲੋ ਲੈਣਾ ਜੀ ਦੱਸ ਦਿਓ ਅਸੀਂ ਰੱਖ ਦਿਆਂਗੇ ਉਦੋਂ ਤੀਹ ਕਿੱਲੋ ਤੋਂ ਜ਼ਿਆਦਾ ਲੈਣਾ ਤਾਂ ਜੀ ਵਿੱਚ ਫਿਰ ਦੱਸ ਕਿੱਲੋ ਗਾਈਆਂ ਦਾ ਲੈਣਾ ਪਊ ਹਾਂਜੀ ਦੇਵਾਂਗੇ ਅੱਡ ਤੁਹਾਨੂੰ ਵਿੱਚ ਨਹੀਂ ਪਾਉਂਦੇ ਅਤੇ ਉਹ ਅੱਡ ਪਾਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂ ਹੁੰਦੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਜੀ